ਯੋਗਾ ਕਰਨ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਮਨ ਸਥਿਰ ਹੁੰਦਾ ਹੈ ਅਤੇ ਵਿਅਕਤੀ ਆਪਣੇ ਅੰਦਰਲੇ ਵਿਚਾਰਾਂ ਉੱਤੇ ਡੂੰਘਾ ਅਸਰ ਪਾਉਣ ਕਰਕੇ ਸਵੈ ਖੋਜ ਦੇ ਰਾਹ 'ਤੇ ਨਿਕਲ ਪੈਂਦਾ ਹੈ ਅਤੇ ਉਸਦਾ ਵਿਅਕਤੀਗਤ ਵਿਕਾਸ ਹੁੰਦਾ ਹੈ